ਮੈਨੂੰ ਕਲਾ ਕਰਨਾ ਬਹੁਤ ਵਧੀਆ ਲੱਗਦਾ ਮੈਨੂੰ ਕਲਾ ਦਾ ਸ਼ੌਂਕ ਹੈ ਮੈਂ ਸ਼ੁਰੂ ਤੋਂ ਕਲਾ ਕਰਦੀ ਹਾਂ ਪੇਂਟਿੰਗ ਕਰਦੀ ਹਾਂ ਮਤਲਬ ਮੈਂ ਸਕੂਲ 'ਚ ਵੀ ਪੇਂਟਿੰਗ ਕੀਤੀ ਆ ਉਸ ਤੋਂ ਬਾਅਦ ਵੀ ਕੋਲਜਿਸ 'ਚ ਵੀ ਪੇਂਟਿੰਗ ਕੀਤੀ ਆ ਮੈਨੂੰ ਪ੍ਰਾਈਜ ਵੀ ਮਿਲੇ ਆ ਸਕੂਲ 'ਚ ਵੀ ਪ੍ਰਾਈਜ਼ ਮਿਲਿਆ ਅਤੇ ਉਸ ਤੋਂ ਬਾਅਦ ਕੋਲਜ ਚੋਂ ਵੀ ਮੈਨੂੰ ਇਨਾਮ ਮਿਲੇ ਹੋਏ ਆ ਕਲਾ ਤੋਂ ਲੈ ਕੇ ਮੈਨੂੰ ਕਲਾ ਕਰਨਾ ਵਧੀਆ ਲੱਗਦਾ ਵਾ ਮੈਂ ਈਵਨ ਕਿ ਪੋਰਟਰੇਟਸ ਅਤੇ ਸੀਨਰੀਜ ਵੀ ਬਣਾਈਆਂ ਹੋਈਆਂ ਸਟਿਲ ਲਾਈਵਸ ਵੀ ਬਣਾਈਆਂ ਹੋਈਆਂ ਵਾ ਅਤੇ ਮੈਂ ਮਤਲਬ ਦੇਖ ਦੇਖ ਕੇ ਬਣਾਉਂਦੀ ਹਾਂ ਕਿ ਕਿਸੇ ਦੀ ਮਤਲਬ ਪੋਟਰੇਟ ਕਿਸੇ ਦੀ ਮਤਲਬ ਦੇਖ ਦੇਖ ਕੇ ਮੈਨੂੰ ਬਹੁਤ ਵਧ ਇੰਟਰਸਟ ਆ ਜਦੋਂ ਮੈਂ ਬੋਰ ਹੁੰਦੀ ਹੁੰਦੀ ਹਾਂ ਜਾਂ ਕੁਛ ਮੈਂ ਆਪਣੇ ਵਿਹਲੇ ਟਾਈਮ 'ਤੇ ਮੈਂ ਆਪਣੀ ਪੇਂਟਿੰਗ ਲੈ ਕੇ ਬਹਿ ਜਾਂਦੀ ਆ ਮੈਨੂੰ ਪੇਂਟਿੰਗ ਕਰਨਾ ਵਧੀਆ ਲੱਗਦਾ ਆਪਣੇ ਵਿਹਲੇ ਟਾਈਮ 'ਚ ਅਤੇ ਨਾਲ ਹੀ ਮੈਨੂੰ ਪੇਂਟਿੰਗ ਕਰਨ 'ਚ ਮੈਨੂੰ ਮਜ਼ਾ ਆਉਂਦਾ ਵਾ ਅਤੇ ਉਸ ਤੋਂ ਬਾਅਦ ਕਈ ਪਰ ਮੈਂ ਪੇਂਟਿੰਗ ਦੇ ਨਾਲ ਨਾਲ ਆਪਣੀ ਪਰਸਨਲ ਲਾਈਫ ਵੱਲ ਵੀ ਵੀ ਮੈਂ ਧਿਆਨ ਰੱਖਦੀ ਹਾਂ ਮੈਂ ਬਾਕੀ ਕੰਮ ਵੀ ਕਰਦੀ ਹਾਂ ਨਾਲ ਨਾਲ ਜ਼ਰੂਰੀ ਨਹੀਂ ਆ ਕਿ ਮੈਂ ਪੇਂਟਿੰਗ ਹੀ ਕਰਦੀ ਹਾਂ ਨਾਲ ਨਾਲ ਮੈਂ ਘਰ ਦੇ ਵੀ ਸਾਰੇ ਕੰਮ ਕਰਦੀ ਹਾਂ ਘਰ ਦੇ ਵੀ ਮਤਲਬ ਆਪਣਾ ਇਹ ਨਹੀਂ ਆ ਕਿ ਮੈਂ ਪੇਂਟਿੰਗ ਦੀ ਵਿੱਚ ਹੀ ਰੁੱਝੀ ਰਹਿੰਦੀ ਹਾਂ ਜਾਂ ਮੈਂ ਦੂਸਰੇ ਕੰਮ ਨਹੀਂ ਕਰਦੀ ਮੈਂ ਆਪਣੇ ਨਾਲ ਨਾਲ ਦੂਸਰੇ ਕੰਮ ਵੀ ਕਰਦੀ ਹਾਂ ਆਪਣੀ ਪਰਸਨਲ ਲਾਈਫ ਵੀ ਵੀ ਵੇਖਦੀ ਹਾਂ ਕਈਆਂ ਨੂੰ ਮੈਂ ਦੇਖਿਆ ਵਾ ਕਿ ਉਹ ਹਰ ਵਕਤ ਜੇ ਪੇਂਟਿੰਗ ਮਤਲਬ ਕਲਾ ਵੱਲ ਹੁੰਦੇ ਆ ਤਾਂ ਉਹ ਕਲਾ ਵੱਲ ਹੀ ਹੋ ਜਾਂਦੇ ਆ ਆਪਣੀ ਪਰਸਨਲ ਲਾਈਫ ਭੁੱਲ ਜਾਂਦੇ ਆ ਪਰ ਇੱਦਾਂ ਨਹੀਂ ਕਰਨਾ ਚਾਹੀਦਾ ਕਲਾ ਦੇ ਨਾਲ ਨਾਲ ਆਪਣੀ ਦੂਸਰੀ ਲਾਈਫ ਵੀ ਹੁੰਦੀ ਆ ਉੱਥੇ ਵੀ ਕੰਮ ਕਾਰ ਪਰਸਨਲ ਲਾਈਫ ਕਰਨੀ ਚਾਹੀ ਮਤਲਬ ਦੇ ਦੇਖਣੀ ਚਾਹੀਦੀ ਆ ਸਾਨੂੰ ਨਾਲ ਨਾਲ ਕਲਾ ਦੇ ਨਾਲ ਨਾਲ ਨੇ ਪਰਸਨਲ ਲਾਈਵ ਵੱਲ ਵੀ ਧਿਆਨ ਰੱਖਣਾ ਚਾਹੀਦਾ ਵਾ ਅਤੇ ਮੈਂ ਆਪਣਾ ਕਲਾ ਦੇ ਨਾਲ ਨਾਲ ਆਪਣੀ ਪਰਸਨਲ ਲਾਈਫ ਵੱਲ ਵੀ ਧਿਆਨ ਰੱਖਦੀ ਹਾਂ ਪ੍ਰੋਪਰ ਅਤੇ ਮ ਦੂਸਰੇ ਕੰਮ ਵੀ ਨਾਲ ਨਾਲ ਕਰਦੀ ਹਾਂ ਅਤੇ ਕਲਾ ਕਰਨ ਨਾਲ ਮੈਨੂੰ ਮਤਲਬ ਵਧੀਆ ਫੀਲ ਹੁੰਦਾ ਵਾ ਅਤੇ ਵਧੀਆ ਸਭ ਕੁਛ ਲੱਗਦਾ ਵਾ ਅਤੇ ਮੈਨੂੰ ਕਲਾ ਕਰਨਾ ਬਹੁਤ ਵਧੀਆ ਲੱਗਦਾ ਵਾ ਧੰਨਵਾਦ